ਸਾਨੂੰ ਆਪਣੀ ਵੋਕਲ ਦੀ ਥਕਾਵਟ ਤੋਂ ਬਚਾਅ ਰੱਖਣ ਵਾਸਤੇ ਆਪਣੇ ਗਲੇ ਦੀ ਸੁਰੱਖਿਆ ਵਾਸਤੇ ਖੱਟੀਆਂ ਚੀਜ਼ਾਂ ਅਤੇ ਆਈਸਕ੍ਰੀਮ ਵਰਗੀਆਂ ਠੰਢੀਆਂ ਚੀਜ਼ਾਂ ਤੋਂ ਬਚਾਅ ਰੱਖਣਾ ਚਾਹੀਦਾ ਹੈ ਅਤੇ ਉਸ ਦੀ ਸੰਭਾਲ ਵਾਸਤੇ ਸਾਨੂੰ ਗਰਮ ਪਾਣੀ ਇਹ ਕੋਸੇ ਪਾਣੀ ਇਹ ਨੂੰ ਪੀਣਾ ਚਾਹੀਦਾ ਹੈਗਾ ਅਤੇ ਗਰਾਰੇ ਵਗੈਰਾ ਕਰਨੇ ਚਾਹੀਦੇ ਹੈਗੇ ਹਨ ਅਤੇ ਜੋ ਵੀ ਚੀਜ਼ ਸਾਡੇ ਗਲੇ 'ਤੇ ਅਸਰ ਕਰਦੀ ਹੈਗੀ ਹੈ ਜਿਸ ਚੀਜ਼ ਨਾਲ ਸਾਡਾ ਗਲਾ ਖ਼ਰਾਬ ਹੁੰਦਾ ਹੈ ਅਤੇ ਉਸ ਚੀਜ਼ ਨੂੰ ਸਾਨੂੰ ਨਹੀਂ ਲੈਣਾ ਚਾਹੀਦਾ